ਚਾਰ ਲੱਖ ਅਠਾਹਠ ਹਜ਼ਾਰ ਚਾਰ ਸੌ ਚੁਤਾਲ਼ੀ ਪੰਜ ਲੱਖ ਗਿਆਰਾਂ ਹਜ਼ਾਰ ਇੱਕ ਸੌ ਤੇਰਾਂ ਛੇ ਲੱਖ ਗਿਆਰਾਂ ਹਜ਼ਾਰ ਇੱਕ ਸੌ ਇੱਕ ਸੱਤ ਲੱਖ ਸਤਾਰਾਂ ਹਜ਼ਾਰ ਇੱਕ ਸੌ ਚਾਰ ਨੌ ਲੱਖ ਨੜਿਨਵੇਂ ਹਜ਼ਾਰ ਚਾਰ ਸੌ ਇੱਕ